ਸਿੱਖ ਇਤਿਹਾਸ ਦੀ ਮੈਂ ਪਿੱਛੇ ਕਿਤਾਬ ਪੜ੍ਹ ਰਿਹਾ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਬਾਰੇ ਲਿਖੀ ਹੋਈ ਸੀ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਸਿਰਸਾ ਨਦੀ 'ਤੇ ਵਿਛੋੜਾ ਪੈ ਗਿਆ ਅਤੇ ਉੱਥੇ ਦੋ ਪੁੱਤਰਾਂ ਦੀ ਸ਼ਹੀਦੀ ਚਮਕੌਰ ਸਾਹਿਬ ਅਤੇ ਦੋ ਬੱਚਿਆਂ ਦੀ ਸ਼ਹੀਦੀ ਫਤਿਹਗੜ੍ਹ ਸਾਹਿਬ ਵਿਖੇ ਕੰਧਾਂ 'ਤੇ ਚਿਣ ਕੇ ਕੀਤਾ ਗਿਆ ਉਹ ਵਾਲਾ ਦ੍ਰਿਸ਼ ਸੁਣਨ 'ਤੇ ਸਾਰੇ ਹੀ ਕੋਈ ਵੀ ਸਿੱਖ ਕੌਮ ਦਾ ਬੰਦਾ ਸੁਣਦਾ ਹੈ ਤਾਂ ਉਹਦੀ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਬਹੁਤ ਮੁਸ਼ਕਿਲ ਹੈਗਾ ਸਮਾਂ ਉਹ ਜਿਹੜਾ ਸਿੱਖਾਂ ਨੇ ਉੱਥੇ ਉਸ ਟਾਈਮ ਸਾਹਿਬਜ਼ਾਦਿਆਂ ਨੇ ਆਪਣੀ ਕੁਰਬਾਨੀ ਦੇ ਕੇ ਸਿੱਖਾਂ ਨੂੰ ਇੱਕ ਨਵੀਂ ਪਹਿਲ ਕੀਤੀ ਸੀ